ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਮੈਨੂੰ ਖੁ ਖੁਦ ਨੂੰ ਫੋਟੋਗ੍ਰਾਫੀ ਕਰਨ ਦਾ ਬਹੁਤ ਸ਼ੌਕ ਹੈ ਮੈਂ ਆਪਣੇ ਖੁਦ ਦੀਆਂ ਫੋਟੋ ਬਹੁਤ ਖਿੱਚਦੀ ਹਾਂ ਅਤੇ ਮੈਂ ਆਪਣੇ ਆਲੇ ਦੁਆਲੇ ਵਿੱਚ ਵੀ ਕੁਦਰਤ ਵਿੱਚ ਬਹੁਤ ਫੋਟੋ ਖਿੱਚਦੀ ਹਾਂ ਅਤੇ ਜੇ ਮੈਂ ਕਿਤੇ ਘੁੰਮਣ ਵੀ ਜਾਂਦੀ ਹਾਂ ਆਪਣੀ ਸਹੇਲੀਆਂ ਨਾਲ ਕਿਤੇ ਟਰੈਵਲਿੰਗ ਵਗੈਰਾ 'ਤੇ ਜਾਂ ਵੈਸੇ ਵੀ ਕਿਤੇ ਘੁੰਮਣ ਜਾਂਦੀ ਹਾਂ ਤਾਂ ਮੈਂ ਉੱਥੇ ਵੀ ਆਪਣੀ ਬਹੁਤ ਫੋਟੋਜ਼ ਖਿੱਚਦੀ ਹਾਂ ਉੱਥੇ ਮੈਂ ਅਲੱਗ ਅਲੱਗ ਵਿਊ ਦੀ ਬਹੁਤ ਅਲੱਗ ਅਲੱਗ ਤਰ੍ਹਾਂ ਦੀ ਫੋਟੋ ਖਿੱਚਦੀ ਹਾਂ ਜੋ ਕਿ ਇੱਕ ਯਾਦਗਾਰ ਪਲ ਬਣ ਸਕਣ ਮੇਰਾ ਮੰਨਣਾ ਇਹ ਹੈ ਕਿ ਆਪਾਂ ਫੋਟੋ ਖਿੱਚ ਕੇ ਫੋਟੋ ਦੇ ਦੁਆਰਾ ਆਪਾਂ ਉਹ ਪਲ ਨੂੰ ਕੈਦ ਕਰ ਲੈਂਦੇ ਹਾਂ ਜੋ ਕਿ ਜੋ ਕਿ ਇੱਕ ਯਾਦਗਾਰ ਪਲ ਬਣ ਜਾਂਦੇ ਨੇ ਅਤੇ ਉਹ ਆਪਾਂ ਵਾਰ ਵਾਰ ਜੀ ਸਕੀਏ ਜੇਕਰ ਮੈਂ ਇਹੀ ਫੋਟੋਜ਼ ਆਪਣੇ ਬੁਢਾਪੇ ਵਿੱਚ ਵੀ ਦੇਖਾਂ ਤਾਂ ਮੈਂ ਦੁਬਾਰਾ ਉਹ ਆਪਣੇ ਪਲ ਜੀ ਸਕਦੀ ਹਾਂ ਅਤੇ ਫੋਟੋਗ੍ਰਾਫੀ ਦੇ ਮਾਮਲੇ 'ਚ ਹੁਣ ਮੈਨੂੰ ਲੱਗਦਾ ਕਿ ਮੈਂ ਇੰਨੀ ਕੁ ਮਾਹਰ ਹੋ ਗਈ ਹਾਂ ਇੰਨੀ ਕੁ ਕਾਬਲ ਹੋ ਗਈ ਹਾਂ ਕਿ ਮੈਂ ਕਿਸੇ ਨੂੰ ਸਲਾਹ ਵੀ ਦੇ ਸਕਾਂ ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਬੰਦੇ ਵਿੱਚ ਸ਼ੌਕ ਹੋਣਾ ਚਾਹੀਦਾ ਹੈ ਜੇ ਉਹ ਬਿਨਾ ਉਹਦੇ ਵਿੱਚ ਸ਼ੌਕ ਹੀ ਨਹੀਂ ਹੈਗਾ ਫਿਰ ਕੋਈ ਮਤਲਬ ਨਹੀਂ ਹੈਗਾ ਜੋ ਬੰਦੇ ਵਿੱਚ ਖੁਦ ਫੋਟੋਗ੍ਰਾਫੀ ਕਰਨ ਦਾ ਸ਼ੌਕ ਹੈ ਫਿਰ ਹੀ ਉਹ ਚੰਗੀ ਤਰ੍ਹਾਂ ਫੋਟੋਗ੍ਰਾਫੀ ਸਿੱਖ ਸਕਦਾ ਹੈ ਅਤੇ ਅੱਜ ਕੱਲ੍ਹ ਜਿਵੇਂ ਹੁਣ ਕਈ ਕੋਈ ਲੋਕ ਹੁੰਦੇ ਆ ਕਿ ਜਿਹਨਾਂ ਨੂੰ ਫੋਟੋਗ੍ਰਾਫੀ ਕਰਨ ਦਾ ਬਹੁਤ ਸ਼ੌਕ ਹੁੰਦਾ ਪਰ ਉਹ ਗਰੀਬ ਹੁੰਦੇ ਆ ਜਿਹਨਾਂ ਕੋਲ ਬਹੁਤ ਮਹਿੰਗਾ ਕੈਮਰਾ ਨਹੀਂ ਹੋ ਸਕਦਾ ਜੋ ਉਹ ਨਹੀਂ ਅਫੋ ਅਫੋਡ ਕਰ ਸਕਦੇ ਪਰ ਉਹਨਾਂ ਨੂੰ ਫੋਟੋਗ੍ਰਾਫੀ ਕਰਨ ਦਾ ਬਹੁਤ ਸ਼ੌਕ ਹੁੰਦਾ ਹੈ ਪਰ ਜਿਵੇਂ ਅੱਜ ਕੱਲ੍ਹ ਫੋਨ ਵਗੈਰਾ ਹੁੰਦੇ ਫੋਨ ਵਗੈਰਾ ਤਾਂ ਅੱਜ ਕੱਲ੍ਹ ਸਭ ਕੋਲ ਹੁੰਦੇ ਹੀ ਹੈ ਅਤੇ ਫੋਨਸ ਵਗੈਰਾ 'ਤੇ ਵੀ ਕੈਮਰੇ ਹੁੰਦੇ ਆ ਉੱਥੇ ਵੀ ਆਪਾਂ ਫੋਟੋ ਖਿੱਚਣੀ ਮਤਲਬ ਇੱਕ ਸ਼ੁਰੂਆਤ ਕਰ ਸਕਦੇ ਹਾਂ ਸਿੱਖਣ ਦੀ ਅਤੇ ਇਹ ਦੂਸਰੀ ਗੱਲ ਇਹ ਹੈ ਕਿ ਟੈਕਨਾਲੋਜੀ ਵੀ ਇੰਨੀ ਵੱਧ ਗਈ ਹੈ ਕਿ ਉਹਦੇ ਵਿੱਚ ਵੀ ਅਲੱਗ ਅਲੱਗ ਫੀਚਰਸ ਹੁੰਦੇ ਆ ਉੱਥੇ ਵੀ ਮਤਲਬ ਇੰਸਟਰਕਸ਼ਨ ਵਗੈਰਾ ਬਹੁਤ ਦਿੱਤੀਆਂ ਹੁੰਦੀਆਂ ਉਹਨਾਂ ਨੇ ਕਿ ਆਪਾਂ ਮਤਲਬ ਪੂਰਾ ਉਹਨਾਂ ਨੇ ਦਿੱਤਾ ਹੁੰਦਾ ਕਿ ਕਿੱਦਾਂ ਕਿੱਦਾਂ ਆਪਾਂ ਸਟੈਪ ਬਾਏ ਸਟੈਪ ਸਿੱਖ ਸਕਦੇ ਹਾਂ ਅਤੇ ਦੂਸਰੀ ਤੀਸਰੀ ਗੱਲ ਇਹ ਹੈ ਕਿ ਆਪਾਂ ਐਦਾਂ ਹੀ ਨਹੀਂ ਕਿ ਫੋਟੋਗ੍ਰਾਫੀ ਸਿੱਖ ਸਕਦੇ ਆਪਾਂ ਨੂੰ ਕਿਸੇ ਮਤਲਬ ਇੱਕ ਸਹੀ ਜਿਹੜਾ ਫੋਟੋਗ੍ਰਾਫਰ ਆ ਉਹਦੀ ਸਲਾਹ ਦੀ ਲੋੜ ਹੁੰਦੀ ਆ ਅਤੇ ਆਪਾਂ ਇੱਕ ਮਤਲਬ ਜੋ ਚੰਗਾ ਫੋਟੋਗ੍ਰਾਫੀ ਵਿੱਚ ਉਹਨੂੰ ਆਪਾਂ ਅਪ ਐਜ ਆ ਗੁਰੂ ਮੰਨ ਸਕਦੇ ਹਾਂ ਅਤੇ ਉਹਦੇ ਤੋਂ ਆਪਾਂ ਸਿੱਖ ਸਕਦੇ ਹਾਂ ਕਿ ਮਤਲਬ ਫੋਟੋਗ੍ਰਾਫੀ ਕਿੱਦਾਂ ਕਰਨੀ ਆ ਅਤੇ ਵੈਸੇ ਵੀ ਅੱਜ ਕੱਲ੍ਹ ਔਨਲਾਈਨ ਕੋਰਸ ਵੀ ਬਹੁਤ ਚੱਲਦੇ ਨੇ ਇਹ ਸਿੱਖਣ ਦੇ ਤਾਂ ਆਪਾਂ ਔਨਲਾਈਨ ਕੋਰਸ ਦੇ ਦੁਆਰਾ ਯੂਟੀਊਬ ਵਗੈਰਾ ਦੇ ਦੁਆਰਾ ਯੂਟੀਊਬ 'ਤੇ ਵੀ ਜਿਵੇਂ ਬਹੁਤ ਕੁਛ ਸਿਖਾਇਆ ਜਾਂਦਾ ਹੈ ਆਪਾਂ ਮਤਲਬ ਅੱਜ ਕੱਲ੍ਹ ਸੋਸ਼ਲ ਮੀਡੀਆ ਵੀ ਇੰਨਾ ਗਾ ਸੋਸ਼ਲ ਮੀਡੀਆ ਦਾ ਪਲੇਟਫਾਰਮ ਵੀ ਇੰਨਾ ਕੁ ਹੈ ਕਿ ਆਪਾਂ ਕਿਤੋਂ ਨਾ ਕਿਤੋਂ ਵੀ ਸਿੱਖ ਸਕਦੇ ਹਾਂ ਅਤੇ ਜੇਕਰ ਬੰਦਾ ਅਭਿਆਸ ਨਹੀਂ ਕਰੇਗਾ ਸਭ ਤੋਂ ਵੱਡੀ ਚੀਜ਼ ਹੈ ਕਿ ਅਭਿਆਸ ਕਰਨ ਨਾਲ ਹੀ ਉਹ ਉਸ ਚੀਜ਼ ਵਿੱਚ ਮਾਹਰ ਹੋ ਸਕਦਾ ਜੋ ਉਹਨੇ ਸਿੱਖਣੀ ਹੈ ਅਤੇ ਅਭਿਆਸ ਦੇ ਨਾਲ ਹੀ ਕੋਈ ਬੰਦਾ ਮਾਹਰ ਬਣ ਸਕਦਾ ਹੈ ਅਤੇ ਹੋਰ ਆਪਾਂ ਐਡੀਟਿੰਗ ਵਗੈਰਾ ਵੀ ਸਿੱਖ ਸਿੱਖ ਸਕਦੇ ਹਾਂ ਐਡੀਟਿੰਗ ਸਿੱਖਣੀ ਚਾਹੀਦੀ ਹੈ ਫੋਟੋਗ੍ਰਾਫੀ ਵਿੱਚ ਮਤਲਬ ਉਹ ਚੰਗੀ ਤਰ੍ਹਾਂ ਕ ਫੋਟੋਜ ਵਗੈਰਾ ਮਤਲਬ ਖਿੱਚ ਸਕੇ ਅਤੇ ਜੇ ਉਹ ਹੌਲੀ ਹੌਲੀ ਆਪਣੀ ਉਹ ਕਰੇਗਾ ਪ੍ਰੈਕਟਿਸ ਕਰੇਗਾ ਫਿਰ ਉਹ ਇੱਕ ਨਾ ਇੱਕ ਦਿਨ ਮਾਹਰ ਜ਼ਰੂਰ ਬਣੇਗਾ ਫਿਰ ਜੇ ਉਹ ਪਰਫੈਕਟ ਫੋਟੋਗ੍ਰਾਫਰ ਬਣ ਗਿਆ ਤਾਂ ਉਹ ਛੋਟੇ ਮੋਟੇ ਫੰਕਸ਼ਨ ਵੀ ਬੁੱਕ ਕਰ ਸਕਦਾ ਹੈ ਅਤੇ ਅੱਜ ਕੱਲ੍ਹ ਜਿਵੇਂ ਵਿਆਹ ਸ਼ਾਦੀਆਂ ਦੇ ਫੰਕਸ਼ਨਸ ਵਿੱਚ ਫੋਟੋਗ੍ਰਾਫਰਸ ਦਾ ਹੁਣ ਫੋਟੋਗ੍ਰਾਫਰ ਬਹੁਤ ਆਉਂਦੇ ਨੇ ਉੱਥੇ ਵੀ ਉਹ ਛੋਟੇ ਮੋਟੇ ਫੰਕਸ਼ਨ ਬੁੱਕ ਕਰ ਸਕਦਾ ਹੈ ਉੱਥੇ ਆਪਣਾ ਉਹ ਮਤਲਬ ਇਹਨੂੰ ਆਪਣੇ ਐਜ਼ ਆ ਪੇਸ਼ੇ ਵਿੱਚ ਵੀ ਲੈ ਸਕਦਾ ਉਹ ਕਿ ਉਹਦਾ ਪ੍ਰੋਫੈਸ਼ਨ ਬਣ ਜਾਵੇ ਇਹ ਜਿਸ ਨੇ ਵੀ ਆਪਣਾ ਪ੍ਰੋਫੈਸ਼ਨ ਬਣਾਉਣਾ ਉਹ ਇਸ ਤਰ੍ਹਾਂ ਦੇ ਛੋਟੇ ਮੋਟੇ ਫੰਕਸ਼ਨ ਵੀ ਬੁੱਕ ਕਰ ਸਕਦਾ ਹੈ ਜਿਹਦੇ ਨਾਲ ਉਹਦੀ ਪ੍ਰੈਕਟਿਸ ਵੀ ਹੁੰਦੀ ਰਹੇਗੀ ਅਤੇ ਉਹ ਇੱਕ ਅੱਛਾ ਫੋਟੋਗ੍ਰਾਫਰ ਵੀ ਬਣ ਸਕੇਗਾ ਜੋ ਉਹ ਉਸਦੇ ਮਤਲਬ ਉਹ ਆਪਣੇ ਪੇਸ਼ੇ ਵਿੱਚ ਲੈ ਸਕੇਗਾ ਅਤੇ ਹੋਰ ਬਸ ਇੰਨਾ ਹੀ ਸੀਗਾ ਕਿ ਇੱਕ ਬੰਦਾ ਹੌਲੀ ਹੌਲੀ ਇਹ ਚੀਜ਼ ਸਿੱਖਦਾ ਹੈ ਜੇਕਰ ਉਹ ਪ੍ਰੈ ਅਭਿਆਸ ਨਹੀਂ ਕਰੇਗਾ ਤਾਂ ਉਹ ਮਾਹਰ ਨਹੀਂ ਬਣ ਸਕੇਗਾ ਅਤੇ ਉਸ ਵਿੱਚ ਆਪਣਾ ਸ਼ੌਕ ਵੀ ਹੋਣਾ ਚਾਹੀਦਾ ਹੈ ਧੰਨਵਾਦ